ਹਾਂਜੀ ਦਰਸ਼ਨ ਟੀ ਵੀ ਸੈਂਟਰ ਕੁਰਾਲੀ ਤੋਂ ਬੋਲਦੇ ਹੋ ਜੀ ਜਨਾਬ ਜੀ ਆਪਣੇ ਘਰ ਦੇ ਵਿੱਚ ਨਾ ਵਾਸ਼ਿੰਗ ਮਸ਼ੀਨ ਖਰਾਬ ਹੋਈ ਹੈ ਕਈ ਦਿਨਾਂ ਤੋਂ ਅਤੇ ਅਸੀਂ ਠੀਕ ਕਰਵਾਉਣਾ ਚਾਹੁੰਦੇ ਹਾਂ ਜੀ ਤੁਸੀਂ ਐਡਰੈਸ ਨੋਟ ਕਰ ਲਵੋ ਜੀ ਸਾਡਾ ਵਾਰਡ ਨੰਬਰ ਦੋ ਹਾਊਸ ਨੰਬਰ ਦੋ ਸੌ ਤਿੰਨ ਦਾਸ ਕਲੋਨੀ ਕੁਰਾਲੀ ਸ਼ੁਭ ਨਾਮ ਧਰਮਪਾਲ ਸਿੰਘ ਹੈ ਜੀ ਤੁਸੀਂ ਜਲਦੀ ਤੋਂ ਜਲਦੀ ਮਸ਼ੀਨ ਕਦੋਂ ਠੀਕ ਕਰਵਾ ਦੂੰਗੇ ਜੀ ਨਹੀਂ ਜੀ ਤੁਸੀਂ ਛੇਤੀ ਠੀਕ ਕਰਵਾਉ ਕਿਉਂਕਿ ਸਾਡੇ ਘਰ ਦੇ ਵਿੱਚ ਇੱਕ ਫੰਕਸ਼ਨ ਹੈ ਇਸ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਛੇਤੀ ਤੋਂ ਛੇਤੀ ਠੀਕ ਕਰਵਾ ਦੂੰਗੇ ਜੀ ਤਾਂ ਤਾਂ ਤੁਹਾਡਾ ਬੜਾ ਧੰਨਵਾਦ ਹੈ ਛੇਤੀ ਕਰੋ ਇਸ ਕੰਮ ਦੇ ਲਈ ਹਾਂਜੀ ਫ਼ੋਨ ਨੰਬਰ ਮੇਰਾ ਇਹ ਹੀ ਹੈ ਜੀ ਬਿਲਕੁਲ ਤੁਸੀਂ ਮੈਨੂੰ ਕਾਲ ਕਰਕੇ ਬਿਲਕੁਲ ਆ ਜਾਇਉ ਜੀ ਖਰਚਾ ਕਿੰਨਾਂ ਕੁ ਆਉਣ ਦਾ ਅਨੁਮਾਨ ਹੈ ਜੀ ਇਹਦਾ ਢਾਈ ਸੌ ਰੁਪਇਆ ਤੁਸੀਂ ਲੈਣਾ ਅਤੇ ਪਾਰਟਸ ਦੇ ਜਿਹੜੇ ਪੈਸੇ ਅਲੱਗ ਤੋਂ ਹੋਣਗੇ ਠੀਕ ਹੈ ਜੀ ਧੰਨਵਾਦ